ਵਿਗਿਆਨ ਅਤੇ ਤਕਨੋਲਜੀ ਵਿੱਚ ਤਰੱਕੀ ਨਹੀਂ ਸਿਹਤ ਸੰਭਾਲ ਖੇਤਰ ਵਿੱਚ ਬਹੁਤ ਹੀ ਜ਼ਿਆਦਾ ਤਰੱਕੀ ਕੀਤੀ ਅਤੇ ਸਹੂਲਤ ਵੀ ਕੀਤੀ ਹੈ ਜਿਵੇਂ ਕਿ ਹੁਣ ਹਸਪਤਾਲਾਂ ਵਿੱਚ ਪਹਿਲਾਂ ਲੋਕਾਂ ਨੂੰ ਬਿਮਾਰੀਆਂ ਦਾ ਇਲਾਜ ਕਰਾਉਣ ਲਈ ਦੁ ਦੂਰ ਸ਼ਹਿਰਾਂ ਵਿੱਚ ਜਾਂ ਵੱਡੇ ਹਸਪਤਾਲਾਂ ਵਿੱਚ ਇਲਾਜ ਕਰਾਉਣ ਲਈ ਜਾਣਾ ਪੈਂਦਾ ਸੀਗਾ ਜੋ ਕਿ ਉਹਨਾਂ ਨੂੰ ਬਹੁਤ ਹੀ ਮੁਸ਼ਕਲ ਆਉਂਦੀ ਸੀਗੀ ਜਾਣ ਵਿੱਚ ਅਤੇ ਬਹੁਤ ਹੀ ਜ਼ਿਆਦਾ ਖਰਚਾ ਵੀ ਹੋ ਜਾਂਦਾ ਸੀ ਅਤੇ ਅੱਜ ਇਹ ਅੱਜ ਕੱਲ੍ਹ ਵਿਗਿਆਨਿਕ ਟਕਨੋਲਜੀ ਕਾਰਨ ਹਰੇਕ ਪਿੰਡਾਂ ਦੇ ਨੇੜੇ ਹਸਪਤਾਲ ਵੀ ਬਣ ਗਏ ਹਨ ਅਤੇ ਉੱਥੋਂ ਲਈ ਬਿਮਾਰੀਆਂ ਦੇ ਇਲਾਜ ਲਈ ਬਹੁਤ ਸਾ ਹਰੇਕ ਬਿਮਾਰੀ ਦਾ ਇਲਾਜ ਵੀ ਹੁਣ ਹੋ ਗਿਆ ਹੈ ਬਹੁਤ ਸਾਰੀਆਂ ਮਸ਼ੀਨਾਂ ਵਗੈਰਾ ਆ ਗਈਆਂ ਹਨ ਜਿਸ ਕਾਰਨ ਬਿਮਾਰੀ ਦਾ ਇਲਾਜ ਵੀ ਹੋ ਸਕਦਾ ਹੈ ਲੋਕ ਨੇ ਆਪਣੇ ਪਿੰਡਾਂ ਦੇ ਨੇੜੇ ਦੇ ਹਸਪਤਾਲ ਵਿੱਚ ਜਾਂ ਕਈ ਪਿੰਡਾਂ ਵਿੱਚ ਵੀ ਹਸਪਤਾਲ ਹਨ ਜਿੱਥੇ ਹਰੇਕ ਬਿਮਾਰੀ ਦਾ ਇਲਾਜ ਹੋ ਸਕਦਾ ਹੈ ਅਤੇ ਲੋਕਾਂ ਨੂੰ ਹੁਣ ਕੋਈ ਵੀ ਤਕਲੀਫ਼ ਨਹੀਂ ਆਉਂਦੀ ਆਪਣਾ ਇਲਾਜ ਕਰਾਉਣ ਲਈ ਅਤੇ ਹਰੇਕ ਹਸਪਤਾਲ ਵਿੱਚ ਹਰੇ ਅਚ ਬਹੁਤ ਸਾਰੀਆਂ ਸਹੂਲਤਾਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਜਿਸ ਕਾਰਨ ਲੋਕਾਂ ਨੂੰ ਕੋਈ ਵੀ ਬਿਮਾਰੀ ਦਾ ਇਲਾਜ ਕਰਾਉਣ ਲਈ ਕੋਈ ਵੀ ਸਮੱਸਿਆ ਨਹੀਂ ਆਉਂਦੀ ਅਤੇ ਵਿਗਿਆਨਕ ਟੈਕਨੋਲਜੀ ਨੇ ਸਿਹਤ ਦੇ ਖੇਤਰ ਵਿੱਚ ਬਹੁਤ ਹੀ ਜ਼ਿਆਦਾ ਤਰੱਕੀ ਕੀਤੀ ਹੈ ਅਤੇ ਇਸ ਲੋਕਾਂ ਦੀ ਬਹੁਤ ਜ਼ਿਆਦਾ ਮਦਦ ਵੀ ਕੀਤੀ ਆ ਲੋਕ ਹੁਣ ਪਹਿਲਾਂ ਨਾਲੋਂ ਘੱਟ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਨੇ ਪਹਿਲਾਂ ਲੋਕਾਂ ਨੂੰ ਬਹੁਤ ਜ਼ਿਆਦਾ ਮੁਸ਼ਕਲ ਆਉਂਦੀ ਸੀ ਬਿਮਾਰੀਆਂ ਦੇ ਇਲਾਜ ਹੋਣ ਲਈ ਪਰ ਹੁਣ ਇਹ ਸਭ ਨਹੀਂ ਹੁੰਦਾ ਹੁਣ ਬਿਮਾਰੀਆਂ ਦਾ ਇਲਾਜ ਛੇਤੀ ਹੋ ਜਾਂਦਾ ਅਤੇ ਲੋਕ ਤੰਦਰੁਸਤ ਵੀ ਰਹਿੰਦੇ ਹਨ ਕੋਵਿਨ ਐਪ ਇੱਕ ਅਜਿਹੀ ਐਪ ਹੈ ਜਿਸਨੇ ਲਾਕਡਾਊਨ ਸਮੇਂ ਲੋਕਾਂ ਦੀ ਬਹੁਤ ਮਦਦ ਕੀਤੀ ਹੈ ਪਹਿਲਾਂ ਲੋਕਾਂ ਨੂੰ ਸਿਹਤ ਸ ਕੇਂਦਰ ਵਿੱਚ ਬੈਕਸੀਨ ਲਗਾਉਣ ਲਈ ਜਾਣਾ ਪੈਂਦਾ ਸੀ ਜਿਸ ਨਾਲ ਬਹੁਤ ਹੀ ਜ਼ਿਆਦਾ ਟੈਮ ਖ਼ਰਾਬ ਹੁੰਦਾ ਸੀ ਇਸ ਲਈ ਕੋਵਿਨ ਐਪ ਦੁਆਰਾ ਲੋਕਾਂ ਨੇ ਵੈਕਸੀਨ ਲਗਵਾ ਕੇ ਉਥੋਂ ਹੀ ਆਪਣਾ ਸਰਟੀਫਿਕੇਟ ਤਿਆਰ ਕਰ ਲਿਆ ਅਤੇ ਉਹਨਾਂ ਦਾ ਬਹੁਤ ਜ਼ਿਆਦਾ ਹੀ ਟੈਮ ਦੀ ਬਚਤ